ਹਾਂਜੀ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਠੀਕ ਹੈ ਸਰ ਤੁਸੀਂ ਤੁਸੀਂ ਜਾਣਾ ਕਿੱਥੇ ਕਿੱਥੇ ਹੈ ਜੀ ਸਰ

ਸਰ ਦਿੱਲੀ ਦਿੱਲੀ ਸ਼ਹਿਰ ਵਿੱਚ ਤਾਂ ਆਪਣੇ ਬ ਬਹੁਤ ਆ ਜਾਂਦੇ ਆਪਣੇ ਆਪਣੇ ਇੱਥੇ ਤੋਂ ਅਸੀਂ ਇੱਥੇ ਮੋਹਾਲੀ ਤੋਂ ਬੋਲ਼ਦੇ ਹਾਂ ਅਤੇ ਹਾਂਜੀ ਇੱਕ ਤਾਂ ਆਪਣੇ ਸਿੱਧੀ ਇੱਕ ਇੱਕ ਤਾਂ ਆਪਣੇ ਪੂਨੇ ਐਕਸਪ੍ਰੈਸ ਹੋ ਗਈ ਉਹ ਸਿੱਧੀ ਦਿੱਲੀ ਹੋ ਕੇ ਜਾਊਗੀ ਉਹ ਸਟੇਅ ਕਿਤੇ ਨਹੀਂ ਕਰੇਗੀ ਹੈਗੀ ਅਤੇ ਹੁਣ ਆਪਾਂ ਨੇ ਇੱਕ ਆਪਾਂ ਨੂੰ ਚਾਹੀਦੀ ਕਿੱਦਾਂ ਨੋਨ ਏ ਸੀ ਟਿਕਟ ਚਾਹੀਦੀ ਜਾਂ ਜਰਨਲ ਚਾਹੀਦੀ ਹੈ ਏ ਸੀ ਵਾਲੀ ਤਾਂ ਸ ਹਾਂਜੀ ਏ ਸੀ ਵਾਲੀ ਦਾ ਤਾਂ ਸਰ ਕਿਰਾਇਆ ਹੋਊਗਾ ਆਪਣਾ ਸਿੰਗਲ ਦਾ ਪੰਜ ਸੌ ਰ ਹਜ਼ਾਰ ਰੁਪਈਆ ਜੀ ਅਤੇ ਹਾਂਜੀ ਆਪਾਂ ਹਾਂਜੀ ਉਹਦੇ ਮੇ ਤੁਹਾਨੂੰ ਪਰ ਸਭ ਕੁਛ ਉਹਦੇ ਮੇ ਬੈੱਡ ਤੁਹਾਨੂੰ ਤੁਹਾਨੂੰ ਬੈੱਡ ਅਤੇ ਵਗੈਰਾ ਸਭ ਕੁਛ ਪ੍ਰੋਵਾਈਡ ਹੋਊਗਾ ਕੰਬਲ ਵਗੈਰਾ ਸਭ ਕੁਛ ਮਿਲੇਗਾ ਜੀ ਅਤੇ ਬਾਕੀ ਖਾਣ ਪੀਣ ਦੀ ਵੀ ਸਹੂਲਤ ਸਾਨੂੰ ਬਿਲਕੁਲ ਕਿਉਂਕਿ ਉਹਦੇ ਵਿੱਚ ਹੀ ਤੁਹਾਡਾ ਸਭ ਕੁਛ ਆਊਗਾ ਜੀ ਟਿਕਟ ਦੇ ਉਹਦੇ ਵਿੱਚ ਹੀ ਹੋਊਗਾ ਜੀ ਤੁਹਾਡਾ ਹਾਂਜੀ ਹਾਂਜੀ ਹਾਂਜੀ ਬਾਕੀ ਤੁਸੀਂ ਜਦੋਂ ਵੀ ਬੁੱਕ ਕਰਨਾ ਹੋਇਆ ਤਾਂ ਸਾਨੂੰ ਦੱਸ ਦਿਉ ਅਸੀਂ ਔਨਲਾਈਨ ਤੁਹਾਡਾ ਬੁੱਕ ਕਰ ਦਾਂਗੇ ਜੀ ਹਾਂਜੀ ਓਕੇ ਓਕੇ ਜੀ ਠੀਕ